ਖੇਤੀ ਵਿੱਚ ਅਗਰ ਪੁਰਾਤਨ ਤੌਰ ਦੀ ਗੱਲ ਕੀਤੀ ਜਾਵੇ ਪਹਿਲਾਂ ਹੀ ਪਹਿਲਾਂ ਦੇ ਸਮੇਂ ਵਿੱਚ ਖੇਤੀ ਵਧੀਆ ਕਰਦੇ ਸੀ ਉਸ ਸਮੇਂ ਵਿੱਚ ਕੋਈ ਕੋਈ ਨਵੀਂ ਤਕਨੀਕਾਂ ਨਹੀਂ ਹੁੰਦੀਆਂ ਸੀ ਕੋਈ ਖਾਦ ਕੋਈ ਯੂਰੀਆ ਵਗੈਰਾ ਕੁਛ ਨਹੀਂ ਹੁੰਦਾ ਸੀ ਉਸ ਸਮੇਂ ਵਿੱਚ ਗੋਹੇ ਦੀ ਖਾਦ ਬਣਾ ਕੇ ਕਣਕ ਬੀਜਦੇ ਸਨ ਫਸਲਾਂ ਬੀਜਦੇ ਸਨ ਪਰ ਅੱਜ ਦੀ ਅਗਰ ਜੇ ਅਸੀਂ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਹੀ ਟ ਅੱਜ ਦੀ ਟੈਕਨੋਲਜੀ ਬੜੀ ਹੀ ਫਾਸਟ ਹੋ ਗਈ ਹਨ ਇਸ ਸਮੇਂ ਵਿੱਚ ਸਪਰੇਅ ਡਾਇਆ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਪਹਿਲਾਂ ਪ ਹੁਣ ਇਹ ਫਸਲ ਜੋ ਕਿ ਚਾਲੀ ਦਿਨ 'ਚ ਹੁੰਦੀ ਸੀ ਹੁਣ ਇਹ ਚਵ ਚੀਜ਼ਾਂ ਵਰਤਣ ਕਾਰਨ ਫਸਲ ਪੰਦਰਾਂ ਦਿਨ ਜਾਂ ਪੰਦਰਾਂ ਵੀਹ ਦਿਨ 'ਚ ਹੋ ਜਾਂਦੀ ਹੈ ਪਰ ਇਹਨਾਂ ਦਾ ਜਿੰਨਾ ਫਾਇਦਾ ਹੈ ਆ ਉਨਾਂ ਨੁਕਸਾਨ ਵੀ ਆ ਕਿਉਂਕਿ ਹੁਣ ਇਹ ਚ ਫਸਲਾਂ ਚੀਜ਼ਾਂ ਵਰਤਣ ਨਾਲ ਵੱਤ ਕਈ ਫਸਲਾਂ ਵੱਧ ਤੋਂ ਵੱਧ ਹੋ ਜਾਂਦੀਆਂ ਹਨ ਅਤੇ ਕਈ ਵਾਰ ਘੱਟ ਤੋਂ ਘੱਟ ਵੀ ਹੁੰਦੀਆਂ ਹਨ ਪਰ ਹੁਣ ਚੀਜ਼ਾਂ ਕਾਫੀ ਟਾਈਮ ਦੇ ਹਿਸਾਬ ਨਾਲ ਤਕਨੀਕ ਨਵੀਂ ਆ ਗਈ ਹੈ ਜੋ ਕਿ ਸਪਰੇਹਾਂ ਵਰਤਦੇ ਆਪਾਂ ਯੂਰੀਆ ਵਰਤਦੇ ਹਾਂ ਅਤੇ ਇਹ ਨਾ ਸਾਡਾ ਇਨਸਾਨ ਦਾ ਖਾ ਖਾ ਹੋ ਕੇ ਫਸਲਾਂ ਸਾਡਾ ਅੰਦਰ ਦਾ ਯੂਰੀਆ ਵੀ ਵੱਧਦਾ ਆ ਜੋ ਕਿ ਸਾਨੂੰ ਨੁਕਸਾਨ ਕਰਦਾ ਕਿਉਂਕਿ ਇਹ ਸਭ ਕੈਮੀਕਲ ਪਦਾਰਥ ਹਨ ਅਗਰ ਪੁਰਾਤਨ ਦੌਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਲੋਕ ਕਣਕ ਬੀਜਦੇ ਸੀ ਗੋਹੇ ਦੇ ਮੱਜਰਾਂ ਦੇ ਗੋਹਾ ਗੋਹੇ ਦਾ ਮੱਝਾਂ ਦੇ ਤਾਂ ਖਾਦ ਬਣਾ ਕੇ ਵਰਤੋਂ ਕੀਤੀ ਜਾਂਦੀ ਹਨ ਉਹ ਸਹੀ ਸੀ